ਪੰਜਾਬ ਵਿੱਚ ਸਟਾਰਟਅਪਸ ਆਈ ਟੀ ਉਦਯੋਗ ਅਤੇ ਨਵੇਂ ਨਿਯਮ ਟੈਕਨੋਲਜੀ ਬਹੁਤ ਤੇਜ਼ੀ ਨਾਲ ਵਿਕਾਸ ਕਰ ਰਹੀ ਹੈ ਡੀਜੀਟਲ ਪਰਿਵਰਤਨ ਸਰਕਾਰੀ ਸਕੀਮਾਂ ਅਤੇ ਨਵੀਂ ਸੋਚ ਨੇ ਪੰਜਾਬ 'ਚ ਉਦੇ ਉਦਯੋਗ ਉਦਯੋਗਮਤਾ ਨੂੰ ਇੱਕ ਨਵਾਂ ਰਾਹ ਦਿੱਤਾ ਹੈ ਇਹਦੇ ਵਿੱਚ ਕਈ ਸਾਰੀ ਨਵੀਂ ਟੈਕਨੋਲੋਜੀ ਅਤੇ ਵਪਾਰਿਕ ਵਿਕਾਸ ਲਈ ਕੀਤਾ ਜਾਂਦਾ ਹੈ ਜਿੱਦਾਂ ਕਿ ਡਿਜੀਟਲ ਮਾਰਕਟਿੰਗ ਅਤੇ ਵੀਡੀਓ ਵੀਡੀਓ ਕੋਂਟੈਂਟ ਇਹਦੇ ਵਿੱਚ ਸੋਸ਼ਲ ਮੀਡੀਆ ਐਡਸ ਯੂਟੀਊਬ ਸੋਟ ਸੋਰਟ ਰੀਲਸ ਟਿਕਟੋਕ ਐਂ ਵਗੈਰਾ ਵਗੈਰਾ ਕਈ ਸਾਰੇ ਵ ਵਰਤੋਂ ਕਰਕੇ ਹੀ ਗਾਹਕਾਂ ਤੱਕ ਤੇਜ਼ੀ ਨਾਲ ਪਹੁੰਚਿਆ ਜਾ ਸਕਦਾ ਹੈ ਅਗਲਾ ਉਤਪਾਦਕਤਾ ਵਧਾਉਣ ਲਈ ਟੂਲ 'ਚ ਕਈ ਸਾਰੇ ਟੂਲਸ ਸਨ ਜਿੱਦਾਂ ਕਿ ਨੋਸਨ ਸਲੈਗ ਟਰੇਲੋ ਜੂਮ ਵਰਤੋਂ ਅਤੇ ਕੰਮ ਸਟੀਮਲਾਈਨ ਅਤੇ ਆਟੋਮੇਸ਼ਨ ਹੋ ਰਹੇ ਹਨ ਇਹਦੇ ਵਿੱਚ ਕਈ ਸਾਰੇ ਬੈਨੀਫਿਟਸ ਅਤੇ ਨੁਕਸਾਨ ਵੀ ਹੈ ਨੁਕਸਾਨ ਇਹ ਹੈ ਇਹ ਸਿਰਫ ਪ੍ਰੀਮੀਅਮ ਪ੍ਰੀਮੀਅਮ ਯੂਜੇਸ ਵਾਸਤੇ ਕਾਫ਼ੀ ਵਧੀਆ ਹੈ ਜਿਹੜੇ ਜਿਹੜੇ ਆਪਣੇ ਪੈਸੇ ਦੇ ਬਲਬੂਤੇ ਖਰੀਦ ਸਕਦੇ ਹਨ ਜਿਹੜੇ ਫਰੀ ਕੰਟੈਂਟ ਉਹਦੇ ਵਿੱਚ ਲਿਮਟਿਡ ਯੂਜੇਸ ਅਸੀਂ ਯੂਜ ਕਰ ਸਕਦੇ ਹਨ ਅਗਲਾ ਏ ਆਈ ਅਤੇ ਆਟੋਮੇਸ਼ਨ ਚੈਟਪੋਡਸ ਸੀਆਰਾਮ ਸੋਫਰੇਅਰ ਏ ਆਈ ਬੇਸ ਰਿਕਮੈਂਡੇਸ਼ਨ ਸਿਸਟਮ ਨਾਲ ਬੇਹਤਰੀਨ ਗਾਹਕ ਅਨੁਭਵ ਬਣਾਇਆ ਜਾ ਸਕਦਾ ਹੈ ਅਗਲਾ ਇਹਦੇ ਵਿੱਚ ਕਈ ਸਾਰੇ ਹ ਆ ਜਾਂਦੇ ਆ ਬਿਜ਼ਨਸ ਆ ਜਾਂਦੇ ਹਨ ਅਤੇ ਸਾ ਜਿੱਦਾਂ ਕਿ ਟੈਕਨਨੇਬਲ ਬਿਜ਼ਨਸ ਈਕਮਰਸ ਸਾਸ ਫਿਨਟੈਕ ਵਰਗੇ ਖੇਤਰਾਂ ਵਿੱਚ ਵੱਧ ਰਹੀ ਰੁਚੀ ਡਿਜ਼ੀਟਲ ਟ੍ਰਾਂਸਮੇਸ਼ਨ ਬਲੋਕਚੇਨ ਕਲਾਊਡ ਕੰਪਿਊਟਿੰਗ ਸਾਈਬਰ ਸਕਿਓਰਟੀ ਸਟਾਟਅਪ ਨੂੰ ਨੈਕਸਟ ਲੈਵਲ 'ਤੇ ਲੈ ਲੈ ਜਾਂਦੇ ਹਨ ਸਰਕਾਰੀ ਯੋਜਨਾਵਾਂ ਅਤੇ ਨੇ ਗਾਰਡ ਰਿਸਕ ਫਰੀ ਬਿਜਨਸ ਮਾਡਲ ਜਿਹਦੇ ਵਿੱਚ ਪੰਜਾਬ ਗੌਰਮੈਂਟ ਦੇ ਈਸਟ ਓ ਈਸਟ ਆਫ ਡੂਇੰਗ ਬਿਜਨਸ ਪ੍ਰੋਗਰਾਮ ਨਾਲ ਵਪਾਰ ਸ਼ੁਰੂ ਕਰਨਾ ਹੋਇਆ ਆਸਾਨ ਹੋ ਜਾਂਦਾ ਹੈ ਨਵ ਨਵੀਂ ਨਤਮ ਟੈਕਨੋਲਜੀ ਅਪਣਾਉਣ ਸਟਾਰਟਅਪ ਨੂੰ ਵਧਾਓ ਅਤੇ ਪੰਜਾਬ ਨੂੰ ਆਈ ਟੀ ਅਨੋਵੇਸ਼ਨ ਹਬ ਬਣਾਓ ਇਹਦੇ ਇਸ ਨਾਲ ਪੰਜਾਬ 'ਚ ਕਾਫ਼ੀ ਤਰੱਕੀ ਹੋ ਸਕਦੀ ਹੈ ਜਿੰਨਾ ਕਿ ਪੰਜਾਬ ਅੱਗੇ ਜਾ ਕੇ ਬਹੁਤ ਕੁਝ ਕਰ ਸਕਦਾ ਹੈ ਅਗਰ ਅਸੀਂ ਇਸ ਤਰ੍ਹਾਂ ਹੀ ਅੱਗੇ ਵੱਧਦੇ ਰਹੀਏ